ਪੰਜਾਬ ਵਿੱਚ ਕਲਾ ਅਤੇ ਸ਼ਿਲਪਕਾਰੀ ਦਾ ਕੰਮ ਬਹੁਤ ਜ਼ਿਆਦਾ ਘੱਟਦਾ ਜਾ ਰਿਹਾ ਜਿਵੇਂ ਕਿ ਗੱਲ ਕਰੀਏ ਜੇ ਆਪਾਂ ਜਿੱਦਾਂ ਜਿਹੜੇ ਮਿੱਟੀ ਦੇ ਭਾਂਡੇ ਬਣਾਉਂਦੇ ਸੀਗੇ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਘੱਟ ਗਿਆ ਜੇ ਹੁਣ ਜਿੱਦਾਂ ਤਿਉਹਾਰਾ ਨੂੰ ਜਿੱਦਾਂ ਦਿਵਾਲੀ ਦੇ ਸਮੇਂ ਦੀਵੇ ਵਗੈਰਾ ਜਾ ਉਹਦੀ ਝੱਕਰਿਆਂ ਦੇ ਸਮੇਂ ਝੱਕਰੇ ਲੈ ਲੈਂਦੇ ਆ ਅਤੇ ਅਤੇ ਗੜਬੜਿਆਂ ਦੇ ਟਾਇਮ ਗੜਬੜੇ ਲੇ ਲੈਂਦੇ ਆ ਉਸ ਤੋਂ ਇਲਾਵਾ ਹੋਰ ਅਸੀਂ ਉਹਨਾਂ ਦੇ ਮਿੱਟੀ ਵਾਲੇ ਭਾਂਡੇ ਉਹ ਬਹੁਤ ਘੱਟ ਵਰਤਦੇ ਆ ਅਤੇ ਹੋਰ ਗੱਲ ਕਰੀਏ ਤੈਕਨੋਲਜੀ ਨੇ ਤੈਕਨੋਲਜੀ ਨੇ ਵੀ ਇਸ 'ਤੇ ਜ਼ਿਆਦਾ ਬਹੁਤ ਜ਼ਿਆਦਾ ਅਸਰ ਪਾਇਆ ਹੈ ਜਿਵੇਂ ਕੀ ਗੱਲ ਕੀਤੀ ਜਾਵੇ ਹੁਣ ਮਿੱਟੀ ਦੇ ਭਾਂਡਿਆਂ ਦੀ ਉਹਨਾਂ ਦੀ ਲਾਈਫ ਵੀ ਬਹੁਤ ਘੱਟ ਹੈ ਜਿਹੜੇ ਦੂਜੇ ਅਸੀਂ ਕੱਪ ਵਗੈਰਾ ਯੂਜ਼ ਕਰਦੇ ਹਾਂ ਜਾਂ ਪਲਾਸਟਿਕ ਦਾ ਸਮਾਨ ਹੈ ਉਹਨਾਂ ਦੀ ਥੋੜੀ ਲਾਈਫ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਹਦੇ 'ਤੇ ਬਹੁਤ ਜ਼ਿਆਦਾ ਅਸਰ ਪੈ ਗਿਆ